ਬਚਪਨ ਸਮੇਂ ਮੈਂ ਸਕੂਲ ਦੀ ਛੁੱਟੀਆਂ ਦੌਰਾਨ ਨਾਨਕੇ ਜਾਂਦੀ ਹੁੰਦੀ ਸੀ ਅਤੇ ਉੱਥੇ ਮਾਮੇ ਅਤੇ ਮਾਸੀਆਂ ਦੇ ਬੱਚਿਆਂ ਦੇ ਨਾਲ ਮੈਂ ਬਹੁਤ ਖੇਡਾਂ ਖੇਡਦੀ ਹੁੰਦੀ ਸੀ ਉਹ ਬਚਪਨ ਵਾਲੀਆਂ ਖੇਡਾਂ ਮੈਨੂੰ ਅੱਜ ਵੀ ਬਹੁਤ ਯਾਦ ਆਉਂਦੀਆ ਹਨ